ਹਾਂਜੀ ਮੈਨੂੰ ਮੈਮ ਐਪ ਤੋਂ ਆ ਰਹੇ ਹੈ ਕੁਐਸਚਨ ਆ ਰਹੇ ਹੈ ਮੈਂ ਲਰਨਿੰਗ ਲਾਈਸੈਂਸ ਲਈ ਅਰਜੀ ਮੈਂ ਦੇਣੀ ਸੀ ਦਿੱਤੀ ਹੋਈ ਸੀਗੀ ਅਤੇ ਉਹਦੇ ਮੈਨੂੰ ਕੁਛ ਪੁਸ਼ਟੀ ਨਹੀਂ ਹੋ ਰਹੀ ਹੈਗੀ ਕਿਰਪਾ ਕਰਕੇ ਮੈਨੂੰ ਇਹਦੀ ਅਪਡੇਟ ਵਗੈਰਾ ਬਾਰੇ ਵੇਰਵਾ ਪ੍ਰਦਾਨ ਕਰੋ ਜੀ